ਸਤਿ ਸ਼੍ਰੀ ਅਕਾਲ ਮੈਂ ਪਰਮਜੀਤ ਕੌਰ ਗੁਰਦਾਸਪੁਰ ਤੋਂ ਜੀ ਹਾਂ ਮੈਂ ਸਿਲਾਈ ਕਰਨ ਅਤੇ ਬੁਣਾਈ ਕਰਨ ਦਾ ਸ਼ੌਕ ਸ਼ੁਰੂ ਤੋਂ ਹੀ ਰੱਖਦੀ ਹਾਂ ਅਤੇ ਮੈਂ ਪਹਿਲਾਂ ਸਿਲਾਈ ਕਿਸੇ ਤੋਂ ਸਿੱਖੀ ਸੀ ਅਤੇ ਜਦੋਂ ਦਾ ਮੋਬਾਇਲ ਯੂਟੀਊਬ ਚੱਲ ਰਿਹਾ ਹੈ ਅਤੇ ਮੈਂ ਕਈ ਗੱਲਾਂ ਯੂਟੀਊਬ ਤੋਂ ਸਿੱਖੀਆਂ ਹਨ ਜਿਵੇਂ ਕਿ ਡਿਜ਼ਾਇਨ ਵਾਲੇ ਪੌਂਚੇ ਬਣਾਉਣਾ ਅਤੇ ਡਿਜ਼ਾਇਨ ਵਾਲੇ ਗਲੇ 'ਤੇ ਲੈਸਾਂ ਲਾ ਕੇ ਸੂਟ ਨੂੰ ਤਿਆਰ ਕਰਨ ਦੀ ਵੀ ਜਾਂਚ ਸਿੱਖ ਲਈ ਅਤੇ ਮੈਂ ਫੇਰ ਕੁਝ ਸਕੂਲਾਂ ਪੜ੍ਹ ਕੇ ਜੋ ਲੜਕੀਆਂ ਹਟੀਆਂ ਹਟੀਆਂ ਸਨ ਅਤੇ ਮੈਂ ਉਹਨਾਂ ਨੂੰ ਵੀ ਸਿਲਾਈ ਸਿਖਾਈ ਹੈ ਹਾਂ ਇਸ ਕਲਾ ਨੂੰ ਸਿੱਖਣ ਅਤੇ ਜਾਂ ਸਿਖਾਉਣ ਵੇਲੇ ਮੇਰਾ ਯਾਦਗਾਰੀ ਪਲ ਇਹੋ ਹੈ ਕਿ ਮੈਨੂੰ ਇੱਕ ਕੁੜੀ ਮਿਲੀ ਜਿਸ ਨੂੰ ਸਿਲਾਈ ਸਿਖਾਈ ਸੀ ਜੋ ਕਿ ਬੂਟੀਕ ਖੋਲ੍ਹ ਕੇ ਪੈਸਾ ਕਮਾ ਰਹੀ ਹੈ ਉਹ ਮੇਰੇ ਨਾਲ ਇੱਕ ਯਾਦਗਾਰੀ ਪਲ ਹੈ ਕਿ ਉਹ ਉਸ ਕੁੜੀ ਨੂੰ ਸਿਖਲਾਈ ਕਿ ਮੈਂ ਉਸ ਕੁੜੀ ਨੂੰ ਸਿਲਾਈ ਸਿਖਾਈ ਅਤੇ ਆਪਣਾ ਕੰਮ ਕਰ ਰਹੀ ਸੀ ਇਸ ਲਈ ਉਹ ਕੁੜੀ ਮੈਨੂੰ ਅੱਜ ਯਾਦ ਕਰਦੀ ਹੈ ਅਤੇ ਮੈਂ ਉਸ ਨੂੰ ਧੰਨਵਾਦ